ਹੈਲੋ ਹਾਂਜੀ ਮਕੈਨਿਕ ਬੋਲ ਰਹੇ ਹੋ ਹਾਂ ਮੈਂ ਨਾ ਗੁਰਸੇਵਕ ਸਿੰਘ ਬੋਲ ਰਿਹਾ ਹੈਗਾ ਫਾਜ਼ਿਲਕਾ ਤੋਂ ਮੇਰੇ ਕੋਲੇ ਆਈ ਟਵੈਂਟੀ ਗੱਡੀ ਹੈਗੀ ਆ ਉਹ ਜਿਹੜੀ ਵੈਸੇ ਤਾਂ ਵਾਰੰਟੀ ਦੇ ਵਿੱਚ ਆ ਪਰੰਤੂ ਦਾ ਇਥੇ ਜਿਹੜਾ ਸ਼ੋਰੂਮ ਨਾ ਹੋਣ ਦੇ ਕਾਰਨ ਦਿੱਕਤ ਆ ਰਹੀ ਆ ਉਹਦੀ ਨਾ ਕਿੱਥੇ ਨਾ ਕਿੱਥੇ ਜਾਣੀ ਕਿ ਸੈਂਸਰ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਵਿੰਡੋ ਜਦੋਂ ਬੰਦ ਕਰਦੇ ਤਾਂ ਲਾਈਟ ਜਿਹੜੀ ਔਨ ਰਹਿੰਦੀ ਹੈਗੀ ਆ ਇਹ ਤੁਸੀਂ ਦੇਖੋਂਗੇ ਜਾਂ ਇਲੈਕਟ੍ਰੀਸ਼ਨ ਦੇਖੇਗਾ ਠੀਕ ਠੀਕ ਆ ਠੀਕ ਆ ਉਸ ਦੇ ਨਾਲ ਬਹੁਤ ਸਾਰੀ ਜਿਹੜੀਆਂ ਹੋਰ ਪ੍ਰੋਬਲਮਜ ਵੀ ਆ ਜਾਂਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਛੋਟੀਆਂ ਤਾਂ ਉਹਨਾਂ ਨੂੰ ਵੀ ਤੁਸੀਂ ਸੋਲਵ ਕਰ ਸਕੋਂਗੇ ਜਿਵੇਂ ਵੀਲ ਬਾਇਲੈਂਸ ਕਰਨ ਵਾਲਾ ਇਹਨਾਂ ਦਾ ਕਾਫੀ ਟਾਈਮ ਹੋ ਗਿਆ ਹਾਂ ਵੀਲ ਬੈਂਲਸ ਖਰਾਉਣਾ ਹੈ ਉਸ ਤੋਂ ਇਲਾਵਾ ਜਿਵੇਂ ਰਾਈਟ ਹੈਂਡ ਜਿਹੜਾ ਕਲੱਚ ਦੇ ਮ ਮਤਲਬ ਆਵਾਜ਼ ਆਉਂਦੀ ਕਲੱਚ ਦੀ ਹਾਂ ਉਹ ਆਵਾਜ਼ ਜਿਹੜੀ ਟਿੱਕ ਟਿੱਕ ਦੀ ਆਵਾਜ਼ ਆ ਰਹੀ ਹੈ ਉਹ ਜਿਹੜੀ ਠੀਕ ਕਰਨੀ ਹੈਗੀ ਆ ਇਸ ਤੋਂ ਇਲਾਵਾ ਫੁੱਲ ਸਰਵਿਸ ਵੀ ਕਰਨੀ ਹੈ ਫੁੱਲ ਸਰਵਿਸ ਕਰਨੀ ਏ ਇਹਦੇ ਲਈ ਮੈਨੂੰ ਤੁਸੀਂ ਲੱਗ ਲੱਗ ਤੋਂ ਰੇਟ ਦੱਸੋ ਇਹਦੇ ਵੀਲ ਬੈਲੈਂਸ ਦਾ ਕੀ ਰੇਟ ਲਾਓਗੇ ਤੁਸੀਂ ਓਕੇ ਓਕੇ ਹਾਂ ਜਿਸ ਤਰਾਂ ਕਲੱਚ ਦੀ ਆਵਾਜ਼ ਆ ਰਹੀ ਹੈ ਉ ਉਹਦਾ ਵੀ ਕਰਨਾ ਹੈਗਾ ਠੀਕ ਠੀਕ ਠੀਕ ਹੈ ਤਾਂ ਇਹ ਤੁਸੀਂ ਗੱਡੀ ਜਿਹੜੀ ਕਿੰਨੇ ਟਾਈਮ ਵਿੱਚ ਕਰਦੁੰਗੇ ਤੁਸੀਂ ਇਹਨੂੰ ਰੈਡੀ ਤੁਹਾਡੇ ਕੋਲੇ ਭੇਜ ਸਕਦੇ ਹਾਂ ਅਸੀਂ ਅੱਜ ਸ਼ਾਮ ਨੂੰ ਭੇਜ ਸਕਦੇ ਹਾਂ ਜਾਂ ਕੱਲ੍ਹ ਭੇਜ ਦਿਆਂਗੇ ਤੁਸੀਂ ਦੱਸੋ ਤੁਹਾਡੇ ਕੋਲ ਸਮਾਂ ਕਦੋਂ ਹੋਵੇਗਾ ਅਸੀਂ ਐਕਚੁਲੀ ਜਿਹੜਾ ਜਾਣਾ ਹੈ ਕਿਤੇ ਅੰਮ੍ਰਿਤਸਰ ਜਾਣਾ ਉਸਦੇ ਲਈ ਜ਼ਰੂਰਤ ਸੀ ਬਈ ਜਲਦੀ ਜਿਹੜੀ ਇਹਦੀ ਸਰਵਿਸ ਹੋ ਸਕੇ ਹਾਂ ਕੋਈ ਗੱਲ ਨਹੀਂ ਓਕੇ ਓਕੇ ਜਾਣੀ ਕੱਲ ਆਵਾਂਗੇ ਤਾਂ ਕਿੰਨੇ ਟਾਈਮ ਦੇ ਵਿੱਚ ਤੁਸੀਂ ਕਰ ਦਿਓਂਗੇ ਜੇ ਕੱਲ੍ਹ ਆਉਂਦੇ ਤਾਂ ਅਸੀਂ ਹਾਂ ਹਾਂ ਠੀਕ ਹੈ ਜੀ ਯਾਨੀ ਕਿ ਦੋ ਚਾਰ ਘੰਟਿਆਂ ਦੇ ਵਿੱਚ ਹੋ ਜਾਏਗਾ ਕੰਮ ਠੀਕ ਆ ਰਾਊਂਡ ਆਬਾਊਟ ਦਸ ਬਾਰ੍ਹਾਂ ਹਜ਼ਾਰ ਰੁਪਇਆ ਖਰਚਾ ਆ ਜਾਵੇਗਾ ਠੀਕ ਹੈ ਜੀ ਠੀਕ ਹੈ ਜਾਣੀ ਕਿ ਪਰੋਪਰਲੀ ਜਿਹੜਾ ਚੈੱਕਅਪ ਕਰਨਾ ਬਾਕੀ ਵੀ ਜਿਹੜਾ ਤੁਹਾਨੂੰ ਜ਼ਿਆਦਾਤਰ ਮਿਸਤਰੀ ਨੂੰ ਜ਼ਿਆਦਾ ਪਤਾ ਹੁੰਦਾ ਹੈਗਾ ਕਿਉਂਕਿ ਮਕੈਨਿਕ ਨੂੰ ਪਤਾ ਹੁੰਦਾ ਗੱਡੀ ਦੀ ਆਵਾਜ਼ ਕਿੱਥੋਂ ਆ ਰਹੀ ਹੈ ਇਹ ਬਸ ਹਾਂ ਟਰਾਈ ਲੈ ਕੇ ਫਿਰ ਪਤਾ ਚੱਲੇਗਾ ਚਲੋ ਮੈਂ ਤੁਹਾਡੇ ਕੋਲ ਗੱਡੀ ਭੇਜ ਦੀ ਕਰ ਦਿਆਂਗਾ ਕੱਲ੍ਹ ਠੀਕ ਹੈ ਜੀ ਹਾਂ ਮੋਰਨਿੰਗ ਤੁਹਾਡੇ ਕੋਲੇ ਸੈਵਨ ਓ ਕਲੋਕ ਜਿਹੜੀ ਪਹੁੰਚ ਜੂ ਠੀਕ ਹੈ ਹਾਂ ਤੁਸੀਂ ਥੋੜ੍ਹਾ ਜਿਹਾ ਇਹਨੂੰ ਕਿਊ ਵਿੱਚ ਰੱਖਣਾ ਅਤੇ ਸੱਤ ਵਜੇ ਤੁਹਾਡੇ ਕੋਲ ਪਹੁੰਚ ਜਾਏਗਾ ਠੀਕ ਹੈ ਹਾਂ ਠੀਕ ਸੈਵਨ ਓ ਕਲੋਕ ਤੁਹਾਡੇ ਕੋਲੇ ਆ ਜਾਏਗਾ ਠੀਕ ਹੈ ਹਾਂਜੀ ਇਹ ਚੱਲ ਰਹੀ ਹੈ ਵੈਸੇ ਤਾਂ ਲਾਸਟ ਵੀਕ ਵੀ ਚੱਲ ਰਹੀ ਹੈ ਪ੍ਰੋਬਲਮ ਹਾਂ ਚਲੋ ਠੀਕ ਹੈ ਮੈਂ ਤੁਹਾਡੇ ਕੋਲ ਭੇਜਾਂਗਾ ਠੀਕ ਹੈ ਓਕੇ ਥੈਂਕ ਯੂ ਜੀ